ਹੈਲੋ ਬਿਜਲੀ ਵਾਲੇ ਬੋਲਦੇ ਓ ਜੀ ਹਾਂਜੀ ਜੀ ਮੈਂ ਜੀ ਕ੍ਰਿਸ਼ਨ ਲਾਲ ਬੋਲਦਾ ਅਤੇ ਹਾਂਜੀ ਉਹ ਜੀ ਤੁਸੀਂ ਜਿਹੜੀ ਲਾਈਟ ਪਹਿਲਾਂ ਠੀਕ ਕਰਕੇ ਗਏ ਸੀ ਉਹ ਦੁਬਾਰਾ ਖਰਾਬ ਹੋ ਗਈ ਆ ਉਹੀ ਕੀ ਨਾਮ ਬਾਹਰਲੀ ਸਾਈਡ ਤੋਂ ਆਪਣੇ ਬਾਹਰਲੀ ਸਾਈਡ 'ਤੇ ਜਿਹੜਾ ਆਪਣੇ ਮੀਟਰ ਲੱਗਿਆ ਉੱਥੋਂ ਹਾਂਜੀ ਅਤੇ ਅਸੀਂ ਤੁਹਾਨੂੰ ਕਿਹਾ ਸੀ ਜੀ ਪਹਿਲਾਂ ਵੀ ਤੁਸੀਂ ਪੱਕਾ ਕੰਮ ਕਰਕੇ ਜਾਓ ਤੁਸੀਂ ਮੈਨੂੰ ਲੱਗਦਾ ਕੱਚਾ ਹੀ ਕਰ ਗਏ ਕੰਮ ਹਾਂਜੀ ਉਹ ਪਤਾ ਨਹੀਂ ਓੱਥੋਂ ਹੁਣ ਕੀ ਨਾਮ ਪਹਿਲਾਂ ਵੀ ਓੱਥੇ ਹਾਂਜੀ ਨਹੀਂ ਪਹਿਲਾਂ ਵੀ ਕੀ ਨਾਮ ਸਪਾਰਕਿੰਗ ਜਿਹੀ ਹੋਈ ਜਾਂਦੀ ਸੀ ਹਾਂਜੀ ਅਤੇ ਹੁਣ ਤਾਂ ਜੀ ਫਿਰ ਉਹ ਪਟਾਕਾ ਜਿਹਾ ਵੱਜਾ ਅਤੇ ਉਹ ਲਾਈਟ ਹੀ ਬੰਦ ਹੋ ਗਈ

ਹਾਂਜੀ ਅਤੇ ਫਿਰ ਤੁਸੀਂ ਕਰੋ ਠੀਕ ਉਹਨੂੰ ਆ ਕੇ ਅੱਛਾ ਨਹੀਂ ਦੇਖੋ ਜੀ ਫਿਰ ਅਸੀਂ ਤਾਂ ਫਿਰ ਐਵੇਂ ਹੀ ਬੈਠੇ ਤੁਹਾਨੂੰ ਆਉਣਾ ਹੀ ਪੈਣਾ ਇੱਕ ਵਾਰੀ ਅਸੀਂ ਤੁਹਾਡੇ ਤੋਂ ਹੀ ਕਰਵਾਉਣਾ ਅੱਛਾ ਚਲੋ ਫਿਰ ਹਾਂਜੀ ਥੋੜ੍ਹਾ ਵਧੀਆ ਸਮਾਨ ਲੈ ਕੇ ਆਓ ਵਧੀਆ ਅਤੇ ਤੁਸੀਂ ਕਰੋ ਸਹੀ ਉਹਨੂੰ ਹਾਂਜੀ ਹਮ ਅਤੇ ਕੀ ਨਾਮ ਇੱਕ ਦੋ ਤੁਸੀਂ ਨਾਲ ਹੋਰ ਲਿਆਇਓ ਜੇ ਸਮਾਨ ਇੱਕ ਦੋ ਆਪਾਂ ਪਲੱਗ ਜਿਹੇ ਹੋਰ ਬਦਲਵਾਣੇ ਹੈ ਹਾਂਜੀ ਹਾਂਜੀ ਨਹੀਂ ਕੋਈ ਨਹੀਂ ਹੁਣ ਆਪਾਂ ਕਰਵਾਵਾਂਗੇ ਠੀਕ ਉਹਨੂੰ ਹਾਂ ਅਤੇ ਇੱਕ ਪੱਖਾ ਹੈਗਾ ਅੰਦਰ ਵਾਲਾ ਉਹਦੀ ਵੀ ਤਾਰ ਟੁੱਟੀ ਪਈ ਹੈ ਹਾਂਜੀ ਵੈਸੇ ਤਾਂ ਜੀ ਨਹੀਂ ਨਹੀਂ ਤੁਸੀਂ ਲਿਆਇਆ ਜੇ ਸਮਾਨ ਹਾਂਜੀ ਨਹੀਂ ਨਹੀਂ ਕੋਈ ਨਹੀਂ ਤੁਸੀਂ ਸਮਾਨ ਨਵਾਂ ਪਿਆ ਨਹੀਂ ਜੀ ਤੁਸੀਂ ਨਵਾਂ ਲੈ ਕੇ ਆਓ ਸਮਾਨ ਵਧੀਆ ਆਲਾ ਵਧੀਆ ਕੁਆਲਟੀ ਦਾ ਸਮਾਨ ਲੈ ਕੇ ਆਓ ਤੁਸੀਂ ਵਧੀਆ ਲਗਾਓ ਇਹਦੇ ਇੱਥੇ ਫਿਰ ਵਾਰੀ ਵਾਰੀ ਫਿਰ ਹੋ ਜਾਂਦੇ ਨੇ ਹਾਂ ਇਹ ਕਿਉਂਕੀ ਪੁਰਾਣੀ ਆਪਾਂ ਹਾਂ ਨਹੀਂ ਨਹੀਂ ਤੁਸੀਂ ਪ ਸਾਰਾ ਪੱਕਾ ਕੰਮ ਕਰਕੇ ਜਾਓ ਦੁਬਾਰਾ ਹਾਂ ਦੁਬਾਰਾ ਫਿਰ ਨਹੀਂ ਆਉਣੀ ਚਾਹੀਦੀ ਇਹ ਫਿਰ ਅਸੀਂ ਫਿਰ ਪ੍ਰੇਸ਼ਾਨ ਹੁੰਨੇ ਹਾਂ ਅੱਛਾ ਕੋਈ ਨਹੀਂ ਤੁਸੀਂ ਜਿੰਨਾ ਜਲਦੀ ਹੋ ਸਕੇ ਹਾਂਜੀ ਅਤੇ ਠੀਕ ਹੈ ਜੀ ਅਤੇ ਸਮਾਨ ਸਮੂਨ ਸਾਰਾ ਵਧੀਆ ਲੈ ਕੇ ਆਇਓ ਅੰਦਰ ਦਾ ਵੀ ਕਰਵਾਉਣਾ ਆਪਾਂ ਥੋੜ੍ਹਾ ਹਮ ਠੀਕ ਹੈ ਜੀ ਹਮ ਠੀਕ ਹੈ ਥੈਂਕ ਯੂ ਜੀ